ਅੱਜ ਕੱਲ੍ਹ ਪੰਜਾਬ ਵਿੱਚ ਬਹੁਤ ਧੁੰਦ ਪੈ ਰਹੀ ਹੈ ਜਿਸ ਦੇ ਨਾਲ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੁੰਦਾ ਹੈ ਅਤੇ ਐਕਸੀਡੈਂਟ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ ਪਿਛਲੇ ਦਿਨੀਂ ਹੀ ਇੱਕ ਬਹੁਤ ਹੀ ਦੁਖਦਾਈ ਖਬਰ ਪੜ੍ਹੀ ਕਿ ਪੰਜਾਬ ਦੇ ਚਾਰ ਲੜਕੇ ਜੋ ਇੱਕ ਗੱਡੀ ਰਾਹੀਂ ਸਫਰ ਕਰ ਰਹੇ ਸਨ ਉਹਨਾਂ ਦੀ ਗੱਡੀ ਇੱਕ ਖੜ੍ਹੇ ਹੋਏ ਟਰੱਕ ਦੇ ਵਿੱਚ ਵੱਜੀ ਜਿਸ ਦੇ ਨਾਲ ਉਹਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਜਿਹੀਆਂ ਮੌਸਮ ਦੇ ਵਿੱਚ ਆਈਆਂ ਤਬਦੀਲੀਆਂ ਦੇ ਕਰਕੇ ਅਤੇ ਸਫਰ ਦੇ ਦੌਰਾਨ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਕਰਕੇ ਵੀ ਘਟਨਾਵਾਂ ਸਮਾਜ ਵਿੱਚ ਆਮ ਵਾਪਰਦੀਆਂ ਸੁਣੀ ਜਾਂਦੀਆਂ ਹਨ ਜੋ ਕਿ ਬਹੁਤ ਹੀ ਦੁਖਦਾਈ ਹਨ ਜਦੋਂ ਵੀ ਮੌਸਮ ਵਿਗੜਦਾ ਹੈ ਜਾਂ ਪੰਜਾਬ 'ਚ ਧੁੰਦ ਦੇ ਹਾਲਾਤ ਰਹਿੰਦੇ ਹਨ ਤਾਂ ਉਦੋਂ ਸਫਰ ਕਰਨ ਤੋਂ ਸਰਕਾਰ ਵੱਲੋਂ ਚੇਤਾਵਨੀਆਂ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਲੋਕਾਂ ਦੀ ਕੀਮਤੀ ਜਾਨ ਬਚ ਸਕੇ ਔਰ ਉਹ ਲੋਕ ਆਮ ਤੌਰ 'ਤੇ ਆਪਣਾ ਜੀਵਨ ਬਚਾਉਣ ਅਤੇ ਦੂਜਿਆਂ ਦੇ ਜੀਵਨ ਬਚਾਉਣ ਵਿੱਚ ਵੀ ਮਦਦ ਕਰਨ ਬਹੁਤ ਧੰਨਵਾਦ ਜੀ